ਮੇਰੀ ਮਨਪਸੰਦ ਕਿਤਾਬ ਸਾਡਾ ਪੰਜਾਬ ਹੈ ਇਹਦੇ ਵਿੱਚ ਜਦੋਂ ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਜਿਹੜੇ ਜਿਹੜੇ ਪੰਜਾਬ ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਹੈ ਜਿਹੜੇ ਕੰਪੀਟੀਟਿਵ ਪੇਪਰ ਹੁੰਦੇ ਹੈਗੇ ਆ ਵੀ ਉਹਨਾਂ ਦੀ ਤਿਆਰੀ ਦੀ ਪੰਜਾਬ ਜੀ ਕੇ ਦੀ ਤਿਆਰੀ ਕਿਵੇਂ ਕੀਤੀ ਜਾਵੇ ਤਾਂ ਉਹਨੇ ਮੈਨੂੰ ਬੋਲਿਆ ਕਿ ਪੰਜਾਬ ਜੀ ਕੇ ਦੀ ਤਿਆਰੀ ਕਰਨ ਵਾਸਤੇ ਸਿਰਫ ਔਰ ਸਿਰਫ ਇੱਕੇ ਕਿਤਾਬ ਹੈ ਉਹ ਹੈਗੀ ਹੈ ਸਾਡਾ ਪੰਜਾਬ ਉਹਦੇ ਵਿੱਚੋਂ ਸਾਰੇ ਹੀ ਜਿਹੜੇ ਪੇਪਰ ਦੇ ਕੁਆਸ਼ਨ ਆ ਸਾਰੇ ਉਹਦੇ ਚੋਂ ਹੀ ਬਣਦੇ ਹੈਗੇ ਹੈ ਅਤੇ ਉਹਦੇ ਬਾਰੇ ਜਦੋਂ ਆਪਾਂ ਕਿਤਾਬ ਪਤਾ ਕਰਨ ਲੱਗੇ ਆ ਆਪਾਂ ਚੰਡੀਗੜ੍ਹ ਗਏ ਕਿਤਾਬ ਲੈਣ ਵਾਸਤੇ ਆਪਾਂ ਵੱਖ ਵੱਖ ਦੁਕਾਨਾਂ 'ਤੇ ਗਏ ਤਾਂ ਉੱਥੇ ਜਾਣ ਤੋਂ ਬਾਅਦ ਸਾਨੂੰ ਕਿਤੇ ਕਿਤਾਬ ਨਹੀਂ ਮਿਲੀ ਉਹ ਤੋਂ ਬਾਅਦ 'ਚ ਆਪਾਂ ਐਂਡ 'ਚ ਜਾਣ ਤੋਂ ਬਾਅਦ ਸਾਨੂੰ ਆਪਾਂ ਕੱਕੜ ਬੁੱਕ ਸ਼ੋਪ 'ਤੇ ਗਏ ਤਾਂ ਆਪਾਂ ਉੱਥੇ ਕਿਤਾਬ ਦੇਖੀ ਤਾਂ ਸਾਨੂੰ ਉੱਥੇ ਕਿਤਾਬ ਉਹ ਮਿਲ ਗਈ ਪਰ ਉਹ ਮੁੱਲ ਉਹਦਾ ਜ਼ਿਆਦਾ ਲੈ ਰਿਹਾ ਸੀਗਾ ਜਦੋਂ ਆਪਾਂ ਉਹਨਾਂ ਕੁੱਝ ਕੁ ਕਹਿ ਸੁਣਕੇ ਉਹਦਾ ਕਿਤਾਬ ਕਿਤਾਬ ਦਾ ਉਹਦਾ ਮੁੱਲ ਘੱਟ ਕੀਤਾ ਅਤੇ ਕਿਤਾਬ ਖਰੀਦ ਕੇ ਉਹਤੋਂ ਬਾਅਦ ਆਪਾਂ ਘਰੇ ਆ ਗਏ ਅਤੇ ਹੁਣ ਉਹਤੋਂ ਬਾਅਦ ਮੈਂ ਉਹਦੇ ਤੋਂ ਪੜ੍ਹਨਾ ਸ਼ਰੂ ਕਰ ਦਿੱਤਾ ਏ ਉਹ ਕਿਤਾਬ ਦਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰੀਗਾ ਬਹੁਤ ਵਧੀਆ ਕਿਤਾਬ ਹੈ ਜੀ ਉਹ